ਹੈਲੋ ਵਧੀਆ ਵਧੀਆ ਤੂੰ ਦੱਸੋ ਕਿੱਦਾਂ ਹਾਲਚਾਲ ਤੁਹਾਡਾ ਬੜੇ ਦਿਨਾਂ ਬਾਅਦ ਫੋਨ ਕੀਤਾ ਸਾਡੀ ਯਾਦ ਨਹੀਂ ਆਉਂਦੀ ਅੱਛਾ ਬੜੇ ਬਿਜੀ ਹੋ ਤੁਸੀਂ ਸ਼ਿਮਲਾ ਜਾਣ ਤੋਂ ਬਾਅਦ ਭੁੱਲ ਹੀ ਗਏ ਸਾਨੂੰ ਚਲੋ ਇਹ ਤਾਂ ਹੈ ਤੁਸੀਂ ਕਹਿਣ ਦੀਆਂ ਗੱਲਾਂ ਹੁੰਦੀਆਂ ਇਹ ਤਾਂ ਵਧੀਆ ਵਧੀਆ ਤੂੰ ਦੱਸ ਕਹਿੰਦਾ ਓਥੇ ਕੀ ਚੱਲਦਾ ਪਿਆ ਅੱਜ ਕੱਲ੍ਹ ਮੌਸਮ ਤਾਂ ਠੀਕ ਹੈ ਇੱਥੇ ਸਵੇਰ ਸ਼ਾਮ ਦੀ ਠੰਡ ਆ ਥੋੜ੍ਹੀ ਥੋੜ੍ਹੀ ਚਲਦੀ ਦੁਪਹਿਰੇ ਧੁੱਪ ਨਿਕਲ ਜਾਂਦੀ ਹੈ ਗਰਮੀ ਜ਼ਿਆਦਾ ਹੋ ਜਾਂਦੀ ਹੈ ਦੁਪਹਿਰੇ ਇੱਕ ਇਹੀ ਆ ਹੁਣ ਤੂੰ ਕੀ ਕਰਨਾ ਬਾਰ੍ਹਵੀਂ ਹੋਗੀ ਤੇਰੀ ਦੇਖ ਲੈ ਕਾਲਜ ਅਪਲਾਈ ਕਰ ਲਾ ਸਾਡੇ ਮੈਂ ਬੀ ਗੋਰਮੈਂਟ ਕਾਲਜ ਕਰਦਾ ਪਿਆ ਬੀਕੌਮ ਕਰ ਲੈ ਫੀਸ ਵੀ ਘੱਟ ਆ ਹਾਂ ਫਾਰਮ ਨਿਕਲਣੇ ਆ ਹਲੇ ਇੱਕ ਹਫਤੇ ਤੱਕ ਹਾਂ ਅਤੇ ਫਾਰਮ ਭਰ ਲਓ ਉੱਥੇ ਹੈਗਾ ਹੋਸਟਲ ਵੀ ਹੈਗਾ ਕੁੜੀਆਂ ਲਈ ਤਾਂ ਹੈਗਾ ਹੋਸਟਲ ਵਧੀਆ ਹਮ ਇਹੀ ਆ ਮੇਨ ਤਾਂ ਮੌਸਮ ਉਥੇ ਕਿੱਦਾਂ ਦਾ ਮੌਸਮ ਆ ਠੰਡ ਹੋਣੀ ਜ਼ਿਆਦਾਤਰ ਤਾਂ ਹਾਂ ਇੱਥੇ ਵੀ ਅਗਰ ਤੂੰ ਗਵਰਮੈਂਟ ਕੋਲਜ ਆਉਣਾ ਤਾਂ ਇੱਥੇ ਇਹੀ ਹੈ ਕਿ ਜਨਵਰੀ ਤੋਂ ਲੈ ਕੇ ਮਾਰਚ ਤੱਕ ਤਾਂ ਮੇਨ ਥੋੜ੍ਹੀ ਠੰਡ ਗਰਮੀ ਚਲਦੀ ਰਹਿੰਦੀ ਜਨਵਰੀ ਫਰਬਰੀ ਵਿੱਚ ਤਾਂ ਮਾਰਚ ਅਪ੍ਰੈਲ ਵਿੱਚ ਗਰਮੀ ਗੁਰਮੀ ਆ ਜਾਂਦੀ ਹੈ ਥੋੜ੍ਹੀ ਅਪ੍ਰੈਲ ਤੋਂ ਲੈ ਕੇ ਤੇ ਜੁ ਜੁਲਾਈ ਤੱਕ ਗਰਮੀਆਂ ਚੱਲਦੀ ਰਹਿੰਦੀਆਂ ਫਿਰ ਵਿੱਚ ਕਦੇ ਬਰਸਾਤ ਆ ਜਾਂਦੀ ਆ ਪੈਂਦੀ ਹੈ ਮੌਸਮ ਫਿਰ ਮੇਨ ਤਾਂ ਇਹੀ ਆ ਕੀ ਸਹੀ ਆ ਵੈਸੇ ਮੌਸਮ ਨਾ ਜ਼ਿਆਦਾ ਠੰਡ ਹੁੰਦੀ ਇੰਨੀ ਠੰਡ ਮੇਨ ਦਿਸੰਬਰ ਜਨਵਰੀ ਦੇ ਮੌਸਮ 'ਚ ਆਉਂਦੀ ਥੋੜ੍ਹੀ ਥੋੜ੍ਹੀ ਨਾ ਜ਼ਿਆਦਾ ਠੰਡ ਹੁੰਦੀ ਨਾ ਜ਼ਿਆਦਾ ਗਰਮੀ ਹੁੰਦੀ ਆ ਸ਼ਿਮਲਾ ਤਾਂ ਠੰਡ ਆ ਹੁਸ਼ਿਆਰਪੁਰ ਤਾਂ ਹਲੇ ਠੀਕ ਆ ਸ਼ਿਮਲੇ ਨਾਲੋਂ ਜ਼ਿਆਦਾ ਠੰਡ ਨਹੀਂ ਹੁੰਦੀ ਉਹ ਤਾਂ ਪਹਾੜੀ ਇਲਾਕਾ ਆ ਗਿਆ ਬਹੁਤ ਠੰਡ ਹੁੰਦੀ ਆ ਨਹੀਂ ਆ ਹੋਰ ਕਿਵੇਂ ਦੇਖ ਲੈ ਗੋਰਮੈਂਟ ਕੋਲਜ ਸਹੀ ਆ ਹੁਸ਼ਿਆਰਪੁਰ ਆਉਣਾ ਤਾਂ ਵੈਦਰ ਵੁਦਰ ਨਹੀਂ ਇਫੈਕਟ ਕਰਦਾ ਇੰਨਾ ਠੀਕ ਰਹਿੰਦਾ ਇੱਥੇ ਜ਼ਿਆਦਾ ਜ਼ਿਆਦਾ ਨਾ ਗਰਮੀ ਹੁੰਦੀ ਨਾ ਸਰਦੀ ਹੁੰਦੀ ਜ਼ਿਆਦਾ ਠੀਕ ਹੈ ਨਾ ਅਗਰ ਸ਼ਿਮਲੇ ਆ ਜਾਂਗੇ ਘੁੰਮਣ ਕੋਈ ਨਹੀਂ ਘੁੰਮਣਾ ਆਉਂਗੇ ਕਦੀ ਹੋਰ ਤਾਂ ਆ ਹਾਂ ਮੌਸਮ ਦਾ ਪੰਗਾ ਮੌਸਮ ਵੀ ਮੇਨ ਕਰਦਾ ਨਾ ਅੱਜ ਕੱਲ੍ਹ ਉੱਥੇ ਬਹੁਤ ਠੰਡ ਇੱਥੇ ਆ ਨਹੀਂ ਸਕਦੇ ਇੱਥੇ ਤੁਸੀਂ ਅਕੈਡਮੀ ਜਲਦੀ ਮੌਸਮ ਇੱਥੇ ਠੀਕ ਚਲਦਾ ਮੌਸਮ ਇੱਥੇ ਹਾਂ ਉਨੀ ਇੱਥੇ ਆ ਜਾਣਾ ਤੁਸੀਂ ਤੂੰ ਆ ਜਾ ਮਿਲਣ ਸਾਨੂੰ ਇੱਥੇ ਤਾਂ ਇੱਥੇ ਇੱਥੇ ਤਾਂ ਹਾਂ ਇੱਥੇ ਦੇਖ ਲਾ ਗਵਰਮੈਂਟ ਕਾਲਜ ਜਾ ਕੇ ਦੇਖਣੀ ਆ ਕਹਿੰਦੇ ਅਡਮੀਸ਼ਨ ਲੈਣੀ ਚੀਜ ਅਪਲਾਈ ਕਰਨਾ ਕਰਾ ਦੂੰਗਾ ਮੈਂ ਕੰਮ ਸਾਰੇ ਹਾਂ ਇੱਥੇ ਮੌਸਮ ਵਗੈਰਾ ਵੀ ਠੀਕ ਹੀ ਆ ਗਰਮੀ ਦੁਪਹਿਰ ਦੀ ਹੈ ਜ਼ਿਆਦਾ ਗਰਮੀ ਹੈ ਨਹੀਂ ਵੈਸੇ ਇੰਨੀ ਕਦੇ ਕਦੇ ਲੱਗਦੀ ਗਰਮੀ ਜ਼ਿਆਦਾ ਗਰਮੀ ਨਹੀਂ ਲੱਗਦੀ ਹਾਂ ਸਵੇਰੇ ਸ਼ਾਮ ਦੀ ਠੰਡ ਆ ਹੋਰ ਬਸ ਜ਼ਿਆਦਾ ਨਹੀਂ ਆ ਨਹੀਂ ਹੁੰਦਾ ਕੋਈ ਪੰਗਾ ਹੋਰ ਫਿਰ ਹਾਂ ਉੱਥੇ ਸ਼ਿਮਲਾ ਤਾਂ ਜ਼ਿਆਦਾ ਹੁੰਦੀ ਆ ਇੱਥੇ ਤਾਂ ਠੀਕ ਰਹਿਣਾ ਜਿਹਨੂੰ ਅਗਰ ਤੂੰ ਖਾਣਾ ਤਾ ਅਸੀਂ ਮਿਲੇਗੇ ਮਿਲ ਵੀ ਲੂੰਗੇ ਇਕੱਠੇ ਚਲਾਂਗੇ ਕੋਈ ਨਹੀਂ ਅਰੇਂਜਮੈਂਟ ਤਾਂ ਕਰ ਲੂੰਗੇ ਚਲ ਠੀਕ ਆ ਹਾਂ ਤੁਸੀਂ ਬਿਜ਼ੀ ਬੰਦੇ ਆ ਤੁਹਾਨੂੰ ਕੰਮ ਕੁੰਮ ਹੋਣਾ ਠੀਕ ਆ ਓਕ